ਤਰਨ ਤਾਰਨ ਜ਼ਿਲ੍ਹੇ ਵਿੱਚ ਖੇਤਰ ਸਮਤਲ ਹੈ ਸਾਡਾ ਪੰਜਾਬ ਮੈਦਾਨੀ ਖੇਤਰ ਹੈ ਇਸ ਵਿੱਚ ਗਰਮੀ ਅਤੇ ਸਰਦੀ ਸਮਤਲ ਹੀ ਹੁੰਦੀ ਹੈ ਕੁਝ ਹੋਰ ਰਾਜ ਹਨ ਜਿਨ੍ਹਾਂ 'ਤੇ ਮੌਸਮ ਵਿੱਚ ਉਤਰਾਅ ਚੜਾਅ ਰਹਿੰਦਾ ਹੈ ਪਰ ਹੁਣ ਸਾਡੇ ਇਸ ਖੇਤਰ ਵਿੱਚ ਸਰਦੀ ਕੁਝ ਥੋੜ੍ਹਾ ਸਮਾਂ ਜ਼ਿਆਦਾ ਰਹੀ ਹੈ ਗਰਮੀ ਵੀ ਕਾਫੀ ਅੱਗੇ ਨਾਲੋਂ ਵੱਧ ਚੁੱਕੀ ਹੈ ਜਦੋਂ ਪੱਤਝੜ ਦਾ ਮੌਸਮ ਹੁੰਦਾ ਹੈ ਤਾਂ ਬਹੁਤ ਬਹੁਤ ਵਧੀਆ ਮਾਹੌਲ ਹੁੰਦਾ ਹੈ ਜਦੋਂ ਸਾਉਣ ਦਾ ਮਹੀਨਾ ਆਉਂਦਾ ਹੈ ਤਾਂ ਬਹੁਤ ਜ਼ਿਆਦਾ ਮੀਂਹ ਪੈਂਦੇ ਹਨ ਜਿਸ ਨਾਲ ਸਾਡੀਆਂ ਫਸਲਾਂ ਦਾ ਸ਼ਹਿਰਾਂ ਉੱਤੇ ਬੜਾ ਬੁਰਾ ਅਸਰ ਪੈਂਦਾ ਹੈ ਇੱਕੋ ਇੱਥੋਂ ਦੀ ਜਲਵਾਯੂ ਖੁਸ਼ਕ ਅਤੇ ਨਮੀ ਵਾਲੀ ਹੁੰਦੀ ਹੈ ਜੇਕਰ ਸਰਦੀ ਜ਼ਿਆਦਾ ਹੋਵੇ ਤਾਂ ਜੀਵ ਵੀ ਬਿਮਾਰ ਹੋ ਜਾਂਦੇ ਹਨ ਅਤੇ ਰੋਜ਼ਾਨਾ ਜੀਵਨ ਵਿੱਚ ਹੋਣ ਵਾਲੇ ਕੰਮਾਂ ਕਾਰਾਂ 'ਤੇ ਵੀ ਬੁਰਾ ਪ੍ਰਭਾਵ ਪੈਂਦਾ ਹੈ ਸਾਡੇ ਖੇਤਰ ਵਿੱਚ ਸੜਕਾਂ ਬਣਾਉਣ ਲਈ ਦਰਖਤਾਂ ਦੀ ਕਟਾਈ ਕੀਤੀ ਗਈ ਜਿਸ ਕਾਰਨ ਸਾਡੇ ਗਰਮ ਜਲਵਾਯੂ ਵਿੱਚ ਵਾਧਾ ਹੋਇਆ ਹੈ ਬਰਸਾਤਾਂ ਵਿੱਚ ਵੀ ਬਦਲਾਅ ਦੇਖਿਆ ਗਿਆ ਸਾਉਣ ਦੇ ਮਹੀਨੇ ਮੀਂਹ ਨਹੀਂ ਪੈਂਦੇ ਪੈਂਦਾ ਹੈ ਤਾਂ ਜੇ ਪਹਿਲਾਂ ਪੈਂਦਾ ਹੈ ਤਾਂ ਪੈਂਦਾ ਹੈ ਜਾਂ ਤਾਂ ਮਗਰਲੇ ਮਹੀਨੇ ਪੈਂਦਾ ਹੈ